ਟੋਇਟਾ ਲੈਂਡ ਕਰੂਜ਼ਰ ਟੋਇਟਾ ਹਾਈਰਾਈਡਰ ਟੋਇਟਾ ਹਾਈ ਕਰੋਸ ਟੋਇਟਾ ਗਲਾਂਜ਼ਾ ਮਾਰੂਤੀ ਵਿਟਾਰਾ ਮਟੁ ਮਾਰੂਤੀ ਅਲਟੋ ਮਾਰੂਤੀ ਸਵਿਫਟ ਹੋਂਡਾਈ ਕਰੇਟਾ ਹੋਂਡਾਈ ਵੈ ਵੈਨਿਊ ਜੈਗੋਆਰ ਐਕਸ ਜੇ ਲੈਂਡ ਰੋਵਰ ਸਪੋਟ ਲੈਂਡ ਰੋਵਰ ਡਿਸਕਵਰੀ ਲੈਂਡ ਰੋਵਰ ਰੋ ਲੈਂਡ ਰੋਵਰ ਰੋਜ਼ਰਾਈਸ ਫੈਂਟਮ ਰੋਜ਼ਰਾਈਸ ਗੋਸਟ ਲੈਕਸਿਸ ਫੋਕਸਵੈਗਨ ਫੋਕਸਵੈਗਨ ਪੋਲੋ ਵਰਟਿਸ ਪਿਸਾਟ ਹੋਂਡਾ ਜੈਜ਼ ਹੋਂਡਾ ਕੈਮਰੀ ਟੋਇਟਾ ਕੈਮਰੀ ਡੈਕਸਨ ਗੋ